ਸਤਿ ਸ਼੍ਰੀ ਅਕਾਲ ਅੱਛਾ ਜੀ ਹਾਂ ਤੁਸੀਂ ਕੋਣ ਅੱਛਾ ਅੱਛਾ ਕਿੱਥੋਂ ਆ ਰਹੇ ਤੁਸੀਂ ਅੱਛਾ ਅੱਛਾ ਅੱਛਾ ਅੱਛਾ ਅਤੇ ਪਰ ਗੁਰਦਾਸਪੁਰ ਗੁਰਦਾਸਪੁਰ ਵਿੱਚ ਬੜੀਆਂ ਥਾਵਾਂ ਨੇ ਜਿੱਥੇ ਖਾ ਪੀ ਸਕਦੇ ਹਨ ਇੱਕ ਤਾਂ ਹੈਗੀ ਸ਼ੀਲਾਦੀਨ ਕਮਲ ਸਵੀਟਸ ਇੱਥੇ ਦੋਨੋਂ ਹੀ ਦੇਸੀ ਘਿਓ ਦੀ ਪਿਓਰ ਦੇਸੀ ਘਿਓ ਦੀ ਸਾਰੀ ਡਿਸ਼ਿਜ਼ ਬਣਦੀਆਂ ਮਿਠਾਈਆਂ ਬਣਦੀਆਂ ਅਤੇ ਦੂਸਰਾ ਹੈਗਾ ਹੈ ਇੱਥੇ ਰ ਰਾਧੇ ਰਾਧੇ ਫਿਰ ਕਮਲ ਸਵੀਟਸ ਆਸਟ੍ਰੇਲੀਅਨ ਬੇਕਰੀ ਹੋਰ ਵੀ ਕਾਫੀ ਥਾਵਾਂ ਹਨ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਓਕੇ ਓਕੇ